ਮੈਨੂੰ ਫੋਟੋਆਂ ਖਿੱਚਣ ਦਾ ਬਹੁਤ ਸ਼ੌਕ ਹੈ ਅਤੇ ਖਾਸ ਕਰ ਮੈਂ ਆਪਣੀ ਜਿਹੜੀਆਂ ਤਸਵੀਰਾਂ ਜਦੋਂ ਖਿੱਚਦਾ ਹਾਂ ਉਸ ਤੋਂ ਬਾਅਦ ਜੇ ਕੁਝ ਤਸਵੀਰਾਂ ਨੂੰ ਲੋੜ ਪੈਂਦੀ ਹੈ ਉਹਦੀ ਸੈਟਿੰਗ ਕਰਨ ਦੀ ਤਾਂ ਮੇਰੇ ਇੱਕ ਫੋਨ ਦੇ ਵਿੱਚ ਸੋਫਟਵੇਅਰ ਹੈ ਫੋਟੋਸ਼ ਫੋਟੋਸ਼ੋਪ ਜਿਹਦੇ ਵਿੱਚ ਮੈਂ ਜਾ ਕੇ ਫੋਟੋ ਨੂੰ ਪਾ ਕੇ ਉਹਨੂੰ ਅਡਿਟ ਕਰਦਾ ਹਾਂ ਉਹਦੇ ਵਿੱਚ ਉਹਨੂੰ ਕਰੋਪ ਕਰਦਾ ਹਾਂ ਜਿੰਨੀ ਲੋੜ ਹੋਵੇ ਉਹਨੂੰ ਕਰੋਪ ਕਰਕੇ ਜੇ ਉਹਨੂੰ ਬਰਾਈਟਨਸ ਦੀ ਲੋੜ ਹੈ ਤਾਂ ਉਹਨੂੰ ਬਰਾਈਟ ਬਰਾਈਟਨਸ ਕਰਦਾ ਹਾਂ ਜੇਕਰ ਉਹਨੂੰ ਡਾਰਕਨੈਸ ਦੀ ਲੋੜ ਹੈ ਤਾਂ ਉਹਨੂੰ ਉਹਨੂੰ ਡਾਰਕ ਕਰਦਾ ਹਾਂ ਅਤੇ ਉਹਦੇ ਕਲਰ ਵੀ ਜੋ ਹੋਰ ਤਰ੍ਹਾਂ ਤਰ੍ਹਾਂ ਦੇ ਕਲਰ ਹਨ ਉਹਨਾਂ ਨੂੰ ਵੀ ਜੋ ਸਹੀ ਕਰਦਾ ਹਾਂ ਅਤੇ ਇਹ ਸਾਰਾ ਕੁਛ ਕਰਕੇ ਕਿਉਂਕਿ ਮੈਂ ਸਾਰਾ ਕੁਛ ਤਾਂ ਕਰਦਾ ਹਾਂ ਕਿਉਂਕਿ ਜ਼ਿਆਦਾਤਰ ਮੈਂ ਫੋਟੋਆਂ ਆਪਣੇ ਜੋ ਸੋਸ਼ਲ ਨੈਟਵਰਕ ਹੈ ਜਿਵੇਂ ਕਿ ਫੇਸਬੁੱਕ ਵੱਟਸਐਪ ਉਹਨਾਂ 'ਤੇ ਡੀ ਪੀ ਲਾਉਣੇ ਹੁੰਦੇ ਹਨ ਜਾਂ ਫਿਰ ਆਪਣੇ ਦੋਸਤਾਂ ਮਿੱਤਰਾਂ ਨੂੰ ਭੇਜਣੀਆਂ ਹੁੰਦੀਆਂ ਹਨ ਫੋਟੋਆਂ ਉਹ ਮੈਂ ਇਹ ਤਾਂ ਕਰਦਾ ਹਾਂ ਜੀ